ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮੈਮ ਆਈ ਹਾਂ ਇੱਥੇ ਤੁਹਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਅਤੇ ਮੈਨੂੰ ਇੱਕ ਤੁਹਾਡੀ ਮਦਦ ਦੀ ਲੋੜ ਸੀ ਅਤੇ ਮੈਂ ਨਾ ਇੱਥੇ ਸਾਰਾ ਆਪਣਾ ਘੁੰਮ ਫਿਰ ਲਿਆ ਅੰਮ੍ਰਿਤਸਰ ਸਾਰੀਆਂ ਜਿਹੜੀਆਂ ਵੀ ਥਾਵਾਂ ਹੈਗੀਆਂ ਗੋਲਡਨ ਟੈਂਪਲ ਕੀ ਦੁਰਗਿਆਨਾ ਮੰਦਿਰ ਹੋਰ ਵੀ ਜਿਹੜੀਆਂ ਇੱਥੇ ਥਾਵਾਂ ਸਾਰੀਆਂ ਘੁੰਮ ਲਈਆਂ ਜੋ ਵੀ ਮੇਰੇ ਰਿਸ਼ਤੇਦਾਰਾਂ ਨੇ ਦੱਸੀਆਂ ਅਤੇ ਮੈਂ ਨਾ ਤੁਹਾਡੇ ਕੋਲੋਂ ਪੁੱਛਣਾ ਸੀਗਾ ਕਿ ਮੈਂ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਬੜਾ ਮਸ਼ਹੂਰ ਹੈ ਅਤੇ ਉਹਦੇ ਬਾਰੇ ਮੈਂ ਬੜਾ ਸੁਣਿਆ ਤਾਂ ਤੁਸੀਂ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਉਹਨਾਂ ਬਾਰੇ ਬਾਬਾ ਜੀ ਬਾਰੇ

ਅੱਛਾ ਜੀ ਠੀਕ ਹੈ ਜੀ ਅੱਛਾ ਜੀ

ਅੱਛਾ ਅੱਛ ਠੀਕ ਹੈ ਜੀ ਹਾਂਜੀ ਨਹੀਂ ਆਹ ਤਾਂ ਮੈਨੂੰ ਬੜੇ ਹੀ ਮਤਲਬ ਵਧੀਆ ਗੱਲ ਲੱਗੀ ਤੁਸੀਂ ਦੱਸਿਆ ਕਿ ਕਿੱਦਾਂ ਬਾਬਾ ਜੀ ਨੇ ਇੱਦਾਂ ਆਪਣਾ ਸੀਸ ਤਲੀ 'ਤੇ ਧਰ ਕੇ ਕਹਿੰਦਾ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਜਰੂਰ ਦਰਸ਼ਨ ਕਰਾਂਗੀ ਜੀ ਗੁਰੂਦਵਾਰਾ ਸਾਹਿਬ ਦੇ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ